ਬੈਂਕੋਕ ਪਤਾਇਆ ਆਈਲੈਂਡ ਮਲੇਸ਼ੀਆ ਸਿੰਗਾਪੁਰ ਸਿੰਗਾਪੁਰ ਦੁਬਈ ਨਾਰਥ ਕੋਰੀਆ ਯੂਕਰੇਨ ਰਸ਼ੀਆ ਈਰਾਨ ਇਜ਼ਰਾਇਲ ਚਾਈਨਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨੇਪਾਲ ਤਿੱਬਤ ਸ਼੍ਰੀਲੰਕਾ ਇਰਾਕ ਸਾਊਥ ਕੋਰੀਆ ਕੇਰਲਾ ਹਿਮਾਚਲ ਪ੍ਰਦੇਸ਼ ਗੁਜਰਾਤ ਜੰਮੂ ਕਸ਼ਮੀਰ ਲੇਹ ਲਦਾਖ